ਹੈਲੋ ਸਤਿ ਸ਼੍ਰੀ ਅਕਾਲ ਸਰ ਮੀਸ਼ੋ ਤੋਂ ਬੋਲ ਰਹੇ ਹੋ ਸਰ ਮੈਂ ਨਾ ਇੱਕ ਆਰ ਓ ਆਰਡਰ ਕੀਤਾ ਸੀ ਜੋ ਕਿ ਬਹੁਤ ਵਧੀਆ ਚੱਲ ਰਿਹਾ ਹੈ ਪਾਣੀ ਬਹੁਤ ਵਧੀਆ ਹੈ ਕਲਰ ਵੀ ਬਹੁਤ ਵਧੀਆ ਹੈ ਦੂਸਰੀ ਵਾਰ ਸਰ ਮੈਂ ਫਰਿੱਜ ਔਡਰ ਕੀਤੀ ਸੀ ਪਰ ਫਰਿੱਜ ਉਹ ਨਹੀਂ ਜੋ ਕੀ ਮੈਂ ਪਹਿਲਾਂ ਔਡਰ ਕੀਤੀ ਹੋਈ ਸੀ ਇਹ ਫਰਿੱਜ ਜਦ ਮੈਂ ਖੋਲੀ ਤਾਂ ਉਹਦੇ ਵਿੱਚ ਦਰਵਾਜ਼ੇ ਦੇ ਬਾਹਰ ਬਾਹਰ ਟੋਏ ਪਏ ਹੋਏ ਸੀ ਅਤੇ ਅੰਦਰ ਬਾਹਰ ਵੀ ਪੂਰੀ ਮਤਲਬ ਜਿਵੇਂ ਕਿ ਮੈਂ ਕੋਈ ਚੀਜ਼ ਪ੍ਰੋਪਰ ਰੱਖ ਸਕਾਂ ਉਹ ਚੀਜ਼ ਨਹੀਂ ਹੈਗੀ ਛੋਟੀ ਫਰਿੱਜ ਹੈ ਮੈਂ ਵੱਡੀ ਫਰਿੱਜ ਔਡਰ ਕੀਤੀ ਸੀ ਅਤੇ ਸ ਉਹ ਸਰ ਮੈਂ ਪੂਰਾ ਦਿਨ ਉਹਨੂੰ ਚਲਾਇਆ ਤਾਂ ਉਹਦੀ ਕੂਲਿੰਗ ਵੀ ਚੰਗੀ ਤਰ੍ਹਾਂ ਨਹੀਂ ਹੁੰਦੀ ਅਤੇ ਤੀਸਰੀ ਸਰ ਕਿ ਉਹਦੇ ਵਿੱਚ ਮੈਂ ਜੋ ਵੀ ਚੀਜ਼ ਰੱਖਦੀ ਆ ਉਹ ਪ ਚੰਗੀ ਤਰ੍ਹਾਂ ਟਿਕਦੀ ਨਹੀਂ ਹੈ ਉਹਦੀਆਂ ਜਿਹੜੀਆਂ ਜਾਲੀਆਂ ਉਹ ਵੀ ਟੁੱਟੀਆਂ ਭੱਜੀਆਂ ਹੈ ਤਾਂ ਮੈਨੂੰ ਫਰਿੱਜ ਬਿਲਕੁਲ ਪਸੰਦ ਨਹੀਂ ਆਈ ਤਾਂ ਇਸ ਕਰਕੇ ਸਰ ਤੁਸੀਂ ਨਾ ਥੋੜ੍ਹਾ ਜਿਹਾ ਧਿਆਨ ਰੱਖਿਆ ਕਰੋ ਇਸ ਕਰਕੇ ਤੁਹਾਡੇ ਕਸਟਮਰ ਖਰਾਬ ਹੁੰਦੇ ਆ ਕਸਟਮਰ ਜੋ ਵੀ ਚੀਜ਼ ਔਡਰ ਕਰਦਾ ਉਹਨੂੰ ਉਹ ਹੀ ਚੀਜ਼ ਭੇਜੋ ਨਾ ਕਿ ਹੋਰ ਕੋਈ ਭੇਜੋ ਸਰ ਇਸ ਲਈ ਮੈਂ ਚਾਹੁੰਦੀ ਹਾਂ ਕਿ ਫਰਿੱਜ ਮੈਨੂੰ ਵਾਪਿਸ ਅ ਹੀ ਭੇਜੀ ਜਾਵੇ ਜਿਹੜੀ ਕਿ ਮੈਂ ਆਰਡਰ ਕੀਤੀ ਸੀ ਥੈਂਕ ਯੂ